ਫੀਐਟ ਪਾਂਡਾ ਫੀਐਟ ਪਲਸ ਫੀਐਟ ਮੋਬੀ ਫੀਐਟ ਫਾਸਟ ਬੈਕ ਫੀਐਟ ਟੋਰੋ ਫੀਐਟ ਲੈਨੀਆ ਵੋਕਸਵੈਗਨ ਪੋਲੋ ਵੋਕਸਵੈਗਨ ਵੈਂਟੋ ਵਰਕਸਵੈਗਨ ਐਮੀਓ ਨਿਸ਼ਾਨ ਮਾਈਕਰਾ ਨਿਸਾਨ ਸਨੀ ਨਿਸਾਨ ਰੈਨੋ ਟਾਟਾ ਨੈਨੂ ਟਾਡਾ ਪੰਚ ਟਾਟਾ ਨੈਕਸਨ ਟਾਟਾ ਹੈਰੀਅਰ ਟਾਟਾ ਸਫਾਰੀ ਰੇਂਜ ਰੋਵਰ ਲੈਂਡ ਰੋਵਰ ਜ਼ੀਪ ਡਿਸਕਵਰੀ ਕੀਆ ਕੈਰਨਸ ਕੀਆ ਸੋਨੈਟ ਹੋਂਡਾ ਅਮੇਜ ਹੋਂਡਾ ਬੀ ਆਰ ਵੀ ਹੋਂਡਾ ਡਬਲਿਊ ਆਰ ਵੀ ਮਾਰੂਤੀ ਜੈਨ ਮਾਰੂਤੀ ਵੈਗਨਾ ਮਰੂਤੀ ਬਲੈਨੋ ਮਾਰੂਤੀ ਐਟੀਕਾ ਹੁਡਈ ਆਈ ਟਵੈਂਟੀ ਹੁੰਡਈ ਵਰਨਾ